ਸਾਡਾ ਧਰਮ ਸਾਨੂੰ ਸਮਾਜ ਸੇਵਾ ਬਾਰੇ ਸਿਖਾਉਂਦਾ ਹੈ ਸਾਡਾ ਧਰਮ ਸਾਨੂੰ ਦੱਸਦਾ ਹੈ ਕਿ ਸਮਾਜ ਦੀ ਸੇਵਾ ਕਿਵੇ ਕੀਤੀ ਜਾਣੀ ਚਾਹੀਦੀ ਹੈ ਮੈਂ ਸਿੱਖ ਧਰਮ ਨੂੰ ਬਿਲੌਂਗ ਕਰਦੀ ਹਾਂ ਮੇਰਾ ਧਰਮ ਇਹ ਦੱਸਦਾ ਹੈ ਕਿ ਸਾਨੂੰ ਲੋੜਵੰਦਾਂ ਅਤੇ ਗਰੀਬਾਂ ਬੇਸਹਾਰਿਆਂ ਦੀ ਮੱਦਦ ਕਰਨੀ ਚਾਹੀਦੀ ਹੈ ਇਸ ਵਿੱਚ ਬਾਹਰ ਤੋਂ ਬਾਹਰ ਲਗਾਤਾਰ ਅਭਿਆਸ ਕੀਤੇ ਜਾਣੇ ਚਾਹੀਦੇ ਹਨ ਅਤੇ ਸਮਾਜ ਦੀ ਸੇਵਾ ਲਈ ਇੱਕ ਜੁੱਟ ਹੋ ਕੇ ਰਲ਼ ਮਿਲ ਕੇ ਵੱਧ ਚੜ੍ਹਕੇ ਹਿੱਸਾ ਲੈਣਾ ਚਾਹੀਦਾ ਹੈ ਅਤੇ ਸਾਡੇ ਸਾਡਾ ਧਰਮ ਇਹ ਵੀ ਦੱਸਦਾ ਹੈ ਕਿ ਜੇਕਰ ਕੋਈ ਗਰੀਬ ਬਿਨ੍ਹਾਂ ਪੇਟ ਭਰਕੇ ਖਾਣਾ ਨਹੀਂ ਮਿਲ ਰਿਹਾ ਤਾਂ ਅਸੀਂ ਉਸਦੀ ਸੇਵਾ ਕਰਨੀ ਹੈ ਉਸਨੂੰ ਖਾਣਾ ਦੇਣਾ ਹੈ ਇਸ ਤਰ੍ਹਾਂ ਸਮਾਜ ਇਹ ਸਾਡਾ ਧਰਮ ਇਹ ਸਿਖਾਉਂਦਾ ਹੈ ਕਿ ਸਾਨੂੰ ਲੋੜਵੰਦਾਂ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਕਿਸੇ ਨੂੰ ਸਾਡੀ ਲੋੜ ਹੈ ਤਾਂ ਸਾਨੂੰ ਅੱਗੇ ਆ ਕੇ ਉਸਦੀ ਮਦਦ ਕਰਨੀ ਚਾਹੀਦੀ ਹੈ ਸਿੱਖ ਧਰਮ ਦੇ ਸਾਰੇ ਲੋਕ ਇਸ ਨੂੰ ਇੱਕ ਜੁ ਇੱਕ ਜੁਕਟਾ ਇੱਕ ਜੁਟਤਾ ਵੀ ਲਈ ਪ੍ਰੇਰਿਤ ਕਰਦੇ ਹਨ ਸਿੱਖ ਧਰਮ ਦੇ ਸਾਰੇ ਲੋਕ ਰਲ਼ ਮਿਲਕੇ ਬੇਸਹਾਰਾ ਗਰੀਬਾਂ ਦੀ ਮਦਦ ਕਰਦੇ ਹਨ ਜੇਕਰ ਕਿਤੇ ਕਈ ਵਾਰ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਉਸ ਸਮੱਸਿਆ ਦਾ ਹੱਲ ਬਹੁਤ ਹੀ ਸਮਝਦਾਰੀ ਨਾਲ਼ ਕਰਦੇ ਹਨ ਇਹ ਲੰਗਰ ਵੀ ਲਾਉਂਦੇ ਹਨ ਸਾਡਾ ਧਰਮ ਸਾਨੂੰ ਦੱਸਦਾ ਹੈ ਕਿ ਸਮਾਜ ਦੀ ਸੇਵਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਪਿੱਛੇ ਨਹੀਂ ਹੱਟਣਾ ਚਾਹੀਦਾ ਜੇਕਰ ਕੋਈ ਸਾਡੇ ਸਾਡੇ ਤੋਂ ਮਦਦ ਦੀ ਮੰਗ ਕਰ ਰਿਹਾ ਹੈ ਤਾਂ ਸਾਨੂੰ ਉਸਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜ ਦੀ ਸੇਵਾ ਲਈ ਵਾਰ ਵਾਰ ਅਭਿਆਸ ਕੀਤੇ ਜਾਣੇ ਚਾਹੀਦੇ ਹਨ ਅਤੇ ਸੇਵਾ ਲਈ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ ਸਾਡਾ ਧਰਮ ਇਹ ਸਿਖਾਉਂਦਾ ਹੈ ਕਿ ਸਮਾਜ ਵਿੱਚ ਜੇਕਰ ਕੋਈ ਦੁੱਖੀ ਹੈ ਅੰਗਹੀਣ ਹੈ ਬੇਸਹਾਰਾ ਹੈ ਤਾਂ ਉਸ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ ਉਸਨੂੰ ਜੋ ਵੀ ਸਹੂਲਤ ਚਾਹੀਦੀ ਹੈ ਉਸਨੂੰ ਦੇਣੀ ਚਾਹੀਦੀ ਹੈ ਇਸ ਲਈ ਸਾਨੂੰ ਅਭਿਆਸ ਕਰਨੇ ਚਾਹੀਦੇ ਹਨ